ਪੰਜਾਬ ਵਿੱਚ ਸਿੱਖਿਆ ਦੀ ਸਥਿਤੀ ਜੇ ਬਹੁਤ ਉੱਚ ਪੱਧਰ ਦੀ ਨਹੀਂ ਹੈਗੀ ਤਾਂ ਬਹੁਤ ਨੀਵੇਂ ਪੱਧਰ ਦੀ ਵੀ ਨਹੀਂ ਹੈ ਅਤੇ ਇਸ ਸਮੇਂ ਸਾਡੇ ਸੂਬੇ ਦੇ ਵਿੱਚ ਸਿੱਖਿਆ ਨੂੰ ਲੈ ਕੇ ਜਿਹੜੇ ਨਵੇਂ ਰੁਝਾਨ ਆਏ ਹਨ ਉਹ ਦੇਖਣ ਨੂੰ ਮਿਲਦੇ ਹਨ ਕਿ ਇਹਨਾਂ ਦੇ ਵਿੱਚ ਨਵੀਨੀਕਰਨ ਹੋਇਆ ਹੈ ਮਸ਼ੀਨੀਕਰਨ ਹੋਇਆ ਹੈ ਫੋਰ ਇਗਜ਼ਾਮਪਲ ਇੱਥੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪ੍ਰੋਜੈਕਟਰਸ ਦੀ ਵਰਤੋਂ ਦੇ ਨਾਲ ਬੱਚਿਆਂ ਨੂੰ ਸਿਲੇਬਸ ਸਿਖਾਇਆ ਜਾਂਦਾ ਹੈ ਪੜ੍ਹਾਇਆ ਜਾਂਦਾ ਹੈ ਅਤੇ ਮੰਨ ਲਓ ਕੁਛ ਵੀ ਅਗਰ ਬੱਚੇ ਨੂੰ ਸਿਖਾਉਂਦੇ ਹਨ ਤਾਂ ਉਸ ਦੀ ਇੱਕ ਤਸਵੀਰ ਜਿਹੜੀ ਹੈ ਉਹ ਸਾਹਮਣੇ ਲਿਆਈ ਮੰਨ ਲਓ ਅਗਰ ਤਾਜ ਮਹਿਲ ਬਾਰੇ ਦੱਸਿਆ ਜਾਂਦਾ ਹੈ ਤਾਂ ਤਾਜ ਮਹਿਲ ਦੀ ਤਸਵੀਰ ਦਿਖਾਈ ਜਾਂਦੀ ਹੈ ਅਗਰ ਫੁੱਲਾਂ ਦਾ ਵਰਣਨ ਹੋ ਰਿਹਾ ਤਾਂ ਫੁੱਲਾਂ ਦੇ ਜਿਹੜੀਆਂ ਫੁੱਲਾਂ ਦੀਆਂ ਫੋਟੋਆਂ ਹੈਗੀਆਂ ਉਹ ਬੱਚਿਆਂ ਨੂੰ ਦਿਖਾ ਕੇ ਉਹਨਾਂ ਦੇ ਦਿਮਾਗ ਵਿੱਚ ਚੰਗੀ ਤਰ੍ਹਾਂ ਬਿਠਾਇਆ ਜਾਂਦਾ ਹੈ ਕਿ ਉਹ ਕੀ ਪੜ੍ਹ ਰਹੇ ਹਨ ਸੋ ਇਹ ਜਿਹੜਾ ਨਵੀਨੀਕਰਨ ਹੋਇਆ ਹੈ ਆਧੁਨਿਕਤਾਕਰਨ ਹੋਇਆ ਹੈ ਇਸ ਦੇ ਨਾਲ ਕਾਫੀ ਫਾਇਦੇ ਹਨ ਬੱਚੇ ਜਿਹੜੇ ਹਨ ਉਹ ਜ਼ਿਆਦਾ ਵਧੀਆ ਉਸ ਚੀਜ਼ ਨੂੰ ਸਮਝ ਰਹੇ ਹਨ ਨਾ ਸਿਰਫ ਪੜ੍ਹ ਰਹੇ ਹਨ ਬਲਕਿ ਪੜ੍ਹ ਵੀ ਰਹੇ ਹਨ ਅਤੇ ਸਮਝ ਵੀ ਰਹੇ ਹਨ ਇਸ ਦੇ ਨਾਲ ਹੀ ਅੱਜ ਜੇ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਹੈ ਪਰ ਪ੍ਰਾਈਵੇਟ ਸਕੂਲਸ ਵਿੱਚ ਪੰਜਾਬੀ ਨੂੰ ਜਿਹੜਾ ਹੈ ਉਹ ਪਿੱਛੇ ਛੱਡਿਆ ਗਿਆ ਹੈ ਅਤੇ ਅੰਗਰੇਜ਼ੀ ਦਾ ਇਤਨਾ ਕੁ ਪ੍ਰਚਾਰ ਹੋ ਗਿਆ ਹੈ ਕਿ ਉਹਨਾਂ ਉਹ ਲੋਕ ਜਿਹੜੇ ਹਨ ਜਾਂ ਸ ਬੱਚੇ ਜਿਹੜੇ ਹਨ ਉਹ ਤਾਂ ਅੰ ਅੰਗਰੇਜ਼ੀ ਵਿੱਚ ਗੱਲ ਕਰਦੇ ਹੀ ਹਨ ਜਾਂ ਹਿੰਦੀ ਵਿੱਚ ਗੱਲ ਕਰਦੇ ਹੀ ਹਨ ਪਰ ਉਹਨਾਂ ਦੇ ਮਾਂ ਬਾਪ 'ਤੇ ਵੀ ਜੋਰ ਪਾਇਆ ਜਾਂਦਾ ਕਿ ਉਹ ਘਰ ਦੇ ਵਿੱਚ ਪੰਜਾਬੀ ਘੱਟ ਬੋਲਣ ਜੋ ਕਿ ਬੜੀ ਮਾੜੀ ਗੱਲ ਹੈ ਭਾਵੇਂ ਕਿ ਸਰਕਾਰ ਇਸ ਦੇ ਖਿਲਾਫ ਅ ਜਿਹੜੇ ਕਾਨੂੰਨ ਬਣਾਉਂਦੇ ਹਨ ਪਰ ਇਹਨਾਂ ਨੂੰ ਗਰਾਊਂਡ ਅ ਲੈਵਲ 'ਤੇ ਇੰਪਲੀਮੈਂਟੇਸ਼ਨ ਅਜੇ ਪੂਰੀ ਤਰ੍ਹਾਂ ਨਹੀਂ ਹੋਈ ਹੈ ਅਤੇ ਇੱਕ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਮੋਟੀਆਂ ਫੀਸਾਂ ਹਨ ਮੋਟੀਆਂ ਰਕਮਾਂ ਲੈਂਦੇ ਹਨ ਉਹ ਵੀ ਬਹੁਤ ਮਾੜੀ ਗੱਲ ਹੈ ਸੋ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਬ ਸਿੱਖਿਆ ਪ੍ਰਣਾਲੀ ਹੈ ਉਹ ਰਲੇ ਮਿਲੇ ਜਿਹੜੇ ਹੈ ਨਾ ਨਾਂ ਵਾਚਕ ਅਤੇ ਹਾਂ ਵਾਚਕ ਕਾਫੀ ਜਿਹੜੇ ਜਿਹੜੇ ਤੱਥ ਹਨ ਉਹ ਮੌਜੂਦ ਹਨ